ਹਾਂਜੀ ਸ਼ਹਿਰ ਦੀ ਤੁਲਨਾ ਦੇ ਵਿੱਚ ਨਾ ਜਿਹੜਾ ਪਿੰਡ ਦਾ ਭੋਜਨ ਅਤੇ ਸਾਫ ਹਵਾ ਸਾਫ ਪੌਣ ਪਾਣੀ ਇਥੋਂ ਦਾ ਮਾਰਸ਼ਲ ਆਰਟ ਦਾ ਕਿਉਂਕੀ ਪ੍ਰੈਕਟਿਸ ਕਰਨ ਦੇ ਲਈ ਬਹੁਤ ਵਧੀਆ ਹੁੰਦਾ ਹੈਗਾ ਇਹ ਕਿਉਂਕਿ ਦੇਖੋ ਸ਼ਹਿਰਾਂ ਦੇ ਵਿੱਚ ਨਾ ਤਾਂ ਤਾਜ਼ੀ ਹਵਾ ਹੁੰਦੀ ਹੈ ਨਾ ਭੀੜ ਭੜੱਕਾ ਅਤੇ ਖੁੱਲਾ ਨਹੀਂ ਉੱਥੇ ਹੁੰਦਾ ਆਪਣਾ ਉਹਨਾਂ ਨੂੰ ਰੌਲਾ ਛੱਤ ਵਗੈਰਾ ਦੇ ਉੱਪਰ ਹੀ ਜਾ ਕੇ ਕਰਨਾ ਹੀ ਪੈਂਦੀ ਹੈ ਜੇ ਮਾੜਾ ਮੋਟਾ ਉਹ ਕਰਦੇ ਆ ਤਾਂ ਸਿੱਖਦੇ ਆ ਜਾਂ ਅੰਦਰ ਜਾਂ ਛੋਟੇ ਮੋਟੇ ਕਮਰੇ 'ਚ ਸਿੱਖਦੇ ਆ ਪਰ ਉਹਦੀ ਤੁਲਨਾ ਦੇ ਵਿੱਚ ਸ਼ਹਿਰਾਂ ਦੀ ਤੁਲਨਾਂ ਦੇ ਵਿੱਚ ਪਿੰਡਾਂ ਦੇ ਜਿਹੜਾ ਭੋਜਨ ਪਾਣੀ ਜਿਹੜਾ ਖੁੱਲਾ ਹੁੰਦਾ ਹੈ ਨਾ ਖੁੱਲੀਆਂ ਮੱਝਾਂ ਗਾਵਾਂ ਦਾ ਦੁੱਧ ਖੁੱਲਾ ਹੁੰਦਾ ਦੁੱਧ ਦਹੀਆ ਹੁੰਦੀਆਂ ਨੇ ਅਤੇ ਉਹ ਕਾੜਨੀ ਦੇ ਵਿੱਚ ਦੁੱਧ ਕਾੜ ਕਾੜ ਕੇ ਪੀਂਦੇ ਨੇ ਗੇ ਜਦੋਂ ਪੀਂਦੀ ਆ ਤਾਂ ਆਪਣਾ ਕੀ ਆ ਖੋਏ ਜਿਵੇਂ ਖਾਧਾ ਹੁੰਦਾ ਉਦਾਂ ਹੁੰਦਾ ਉਦਾਂ ਟੇਸਟ ਆਉਂਦਾ ਹੈਗਾ ਇੱਥੋਂ ਤੱਕ ਕਿ ਜਿਹੜੇ ਪਿੰਡਾਂ ਦੇ ਵਿੱਚ ਤਾਂ ਲੋਕ ਹੈ ਨਾ ਜਦੋਂ ਧਾਰ ਕੱਢਦੇ ਕੱਢਦੇ ਹੀ ਉਹ ਥਣਾਂ 'ਚੋ ਸਿੱਧਾ ਦੁੱਧ ਹੀ ਆਪਦੇ ਮੂੰਹ ਦੇ ਵਿੱਚ ਪਾ ਲੈਂਦੇ ਆ ਕਿੰਨਾ ਤਾਜ਼ਾ ਦੁੱਧ ਨੂੰ ਦੁੱ ਅਤੇ ਮੀਨਜ ਤਾਜ਼ਾ ਤਾਜ਼ਾ ਦੁੱਧ ਹੀ ਪੀ ਜਾਂਦੇ ਆ 'ਚ ਕਈ ਵਾਰੀ ਉਹ ਝੱਗ ਬਣੀ ਹੁੰਦੀ ਆ ਬਾਲਟੀ ਬਾਲਟੀ ਮੂੰਹ ਲਾ ਲੈਂਦੇ ਆ ਜਿਹੜੇ ਤਕੜੇ ਪਹਿਲਵਾਨ ਹੁੰਦੇ ਨੇ ਤਾਂ ਜਿਹੜਾ ਕਿ ਇੱਕ ਹਿਸਾਬ ਇੱਥੇ ਪੋਲਿਊਸ਼ਨ ਤੋਂ ਰਹਿਤ ਹੁੰਦਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਇੰਨੇ ਵਹੀਕਲ ਨਹੀਂ ਹੁੰਦੇ ਹੇਗੇ ਜਿਹੜੇ ਸਾਰਾ ਦਿਨ ਆ ਗਏ ਇੱਧਰ ਆ ਗਏ ਜਿਵੇਂ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਹੀਕਲ ਫਿਰਦੇ ਰਹਿੰਦੇ ਨੇ ਧੂੰਆ ਫੈਲਾਉਂਦੇ ਨੇ ਪਰ ਨਹੀਂ ਸ਼ਹਿਰਾਂ ਦੇ ਵਿੱਚ ਸ਼ਾਂਤ ਮਾਹੌਲ ਹੁੰਦਾ ਹੈਗਾ ਅਤੇ ਭੋਜਨ ਪਾਣੀ ਇੱਥੋਂ ਦਾ ਬਹੁਤ ਵਧੀਆ ਹੁੰਦਾ ਹੈਗਾ ਸ਼ਹਿਰਾਂ ਦੀ ਤੁਲਨਾ ਦੇ ਵਿੱਚ ਅਤੇ ਇੱਥੇ ਮਾਰਸ਼ਲ ਆਰਟ ਦਾ ਜਿਹੜਾ ਅਭਿਆਸ ਨਾ ਬਹੁਤ ਵਧੀਆ ਢੰਗ ਨਾਲ ਬਣਦਾ ਹੈਗਾ ਕਿਉਂਕਿ ਭਾਵ ਕੀ ਆ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੁੰਦਾ ਖਾਣ ਪੀਣ ਨੂੰ ਖੁੱਲਾ ਹੁੰਦਾ ਕੋਈ ਫਿਕਰ ਨਾ ਫਾਕਾ ਹੁੰਦਾ ਹੈ ਨਾ ਤੋਂ ਕਿ ਇੰਨੀ ਤਾਜ਼ਗੀ ਦਾ ਇੰਨੇ ਜ਼ਿਆਦਾ ਦਰੱਖਤ ਹੁੰਦੇ ਨੇ ਪਿੰਡਾਂ ਦੇ ਵਿੱਚ ਕਿਤੇ ਮਰਜ਼ੀ ਆਪਦੀ ਪ੍ਰੈਕਟਿਸ ਕਰ ਲਓ ਹੈ ਨਾ ਅਤੇ ਇਹ ਵੀ ਨਹੀਂ ਗਾ ਵੀ ਸ਼ਹਿਰ ਦੂਜਾ ਹੈ ਨਾ ਤਾਂ ਲੋਕ ਤੁਹਾਨੂੰ ਅਤੇ ਪ੍ਰਸ਼ੰਸਾ ਵੀ ਕਰਦੇ ਵੀ ਦੇਖੋ ਫਲਾਨੇ ਦਾ ਮੁੰਡਾ ਮਾਰਸ਼ਲ ਆਰਟ ਦਾ ਅਭਿਆਸ ਕਰੀ ਜਾਂਦਾ ਹੈ ਨਾ ਤਾਂ ਔ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਸ਼ਹਿਰਾਂ ਦੀ ਤੁਲਨਾ ਦੇ ਵਿੱਚ ਜਿਹੜਾ ਪਿੰਡਾਂ ਦਾ ਸਾਡਾ ਭੋਜਨ ਵੀ ਬਹੁਤ ਵਧੀਆ ਹੁੰਦਾ ਹਵਾ ਪੌਣ ਪਾਣੀ ਇੱਥੋਂ ਦਾ ਸਾਫ ਹੈਗਾ ਕੋਈ ਪਲਿਊਸ਼ਨ ਨਹੀਂ ਕੋਈ ਗਲੀਆਂ ਨਾਲੀਆਂ ਦਾ ਪਾਣੀ ਪੂਣੀ ਨਹੀਂ ਖੜਾ ਇੱਥੇ ਐਂ ਪੂਰਾ ਵਧੀਆ ਖੁੱਲਾਂ ਵਾਤਾਵਰਨ ਹੁੰਦਾ ਦਰੱਖਤਾਂ ਦੀ ਇੰਨੀ ਸੋਹਣੀ ਹਵਾ ਹੁੰਦੀ ਹੈ ਹੈ ਨਾ ਅਤੇ ਇੱਕ ਵੱਖਰਾ ਜਿਹਾ ਹੀ ਮਾਹੌਲ ਬਣਦਾ ਹੈਗਾ ਸ਼ੋਰ ਸ਼ਰਾਬੇ ਤੋਂ ਰਹਿਤ ਹੁੰਦਾ ਜਦੋਂ ਕੋਈ ਵੀ ਅਸੀਂ ਜਿਹੜਾ ਕੰਮ ਕਰਦੇ ਹਾਂ ਨਾ ਜਦੋਂ ਸ਼ੋਰ ਸ਼ਰਾਬੇ ਤੋਂ ਰਹਿਤ ਹੋਵੇ ਸਾਡਾ ਮਨ ਖੁਸ਼ ਹੋਵੇ ਤਾਂ ਉਹ ਕੰਮ ਦੇ ਵਿੱਚ ਸਾਨੂੰ ਪਰਪੱਕਤਾ ਹਾਸਿਲ ਜ਼ਰੂਰ ਹੁੰਦੀ ਹੈ ਤਾਂ ਇਹ ਬਿਲਕੁਲ ਸਹੀ ਕਿਹਾ ਹੈਗਾ ਕਿਸੇ ਨੇ ਵੀ ਸ਼ਹਿਰਾਂ ਦੀ ਤੁਲਨਾ ਦੇ ਵਿੱਚ ਪਿੰਡਾਂ ਦਾ ਭੋਜਨ ਅਤੇ ਸਾਫ ਹਵਾ ਮਾਰਸ਼ਲ ਆਰਟ ਦਾ ਅਭਿਆਸ ਕਰਨ ਦੇ ਲਈ ਇੱਕ ਵਧੀਆ ਮਾਹੌਲ ਸਿਰਜਦੀ ਹੈਗੀ ਤਾਂ ਆਪਾਂ ਸਾਰਿਆਂ ਨੂੰ ਇਹਦਾ ਆਨੰਦ ਮਾਨਣਾ ਚਾਹੀਦਾ ਤਾਂ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਵੇਖਣਾ ਚਾਹੀਦਾ ਨਾ ਤਾਂ ਉਹਦੇ ਵਿੱਚ ਸਾਨੂੰ ਅਭਿਆਸ ਕਰਨਾ ਚਾਹੀਦਾ ਉਸ ਖੁੱਲੇ ਵਾਤਾਵਰਨ ਦੇ ਵਿੱਚ ਧੰਨਵਾਦ ਜੀ